ਮੀਡੀਆ ਦੁਆਰਾ ਸਾ ਬਹੁਤ ਹੀ ਇੱਕ ਜਿਹੜਾ ਪੰਜਾਬ ਗੌਰਮੈਂਟ ਵੱਲੋਂ ਜਾਂ ਸਟੇਟ ਵੱਲੋਂ ਇੱਕ ਬਹੁਤ ਹੀ ਚੰਗਾ ਉਪਰਾਲਾ ਜਿਹੜੀ ਮੀਡੀਆ ਦੀ ਸਾਨੂੰ ਪਹਿਲਾਂ ਪੜ੍ਹਾਇਆ ਜਾਂਦਾ ਮੀਡੀਆ ਬਾਰੇ ਫਿਰ ਅਸੀਂ ਮਤਲਬ ਅੱਗੇ ਸਾਡੀ ਜਿੱਦਾਂ ਪੋਸਟਿੰਗ ਹੋ ਜਾਂਦੀਆਂ ਨੇ ਮੀਡੀਆ ਦੀਆਂ ਮੀਡੀਆ ਦੇ ਵਿੱਚ ਤਾਂ ਮੀਡੀਆ ਦੁਆਰਾ ਜਿਹੜਾ ਅਸੀਂ ਘਰ ਬੈਠੇ ਸਾਨੂੰ ਪੰਜਾਬ ਪੰਜਾਬ ਤੋਂ ਬਾਹਰ ਹਰ ਜ਼ਿਲ੍ਹੇ ਹਰ ਤਰ੍ਹਾਂ ਦੀ ਖ਼ਬਰ ਹੈ ਜਿਹੜੀ ਉਹ ਬੜੇ ਹੀ ਵਿਸਥਾਰ ਪੂਰਵਕ ਢੰਗ ਦੇ ਨਾਲ ਅਸੀਂ ਆਪਣੇ ਬੈੱਡ 'ਤੇ ਬੈਠ ਕੇ ਸੁਣ ਲੈਂਦੇ ਆਂ ਅਤੇ ਸਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ ਮੀਡੀਆ ਸਾਨੂੰ ਵਾਰ ਵਾਰ ਇੰਨਾ ਕੁ ਚੰਗੇ ਢੰਗ ਨਾਲ ਪੰਜਾਬੀ ਦੇ ਸ਼ਬਦਾਂ ਨੂੰ ਬਿਆਨ ਕਰਦੇ ਨੇ ਜਦੋਂ ਕਿਤੇ ਕੋਈ ਘਟਨਾ ਹੋ ਜਾਂਦੀ ਹੈ ਤਾਂ ਉਸਨੂੰ ਬਹੁਤ ਹੀ ਚੰਗੇ ਢੰਗ ਨਾਲ ਟੀ ਵੀ 'ਤੇ ਜਾਂ ਚੈਨਲਾਂ 'ਤੇ ਪੇਸ਼ ਕੀਤਾ ਜਾਂਦਾ ਹੈ ਕਿ ਉਸਨੂੰ ਛੋਟੇ ਤੋਂ ਲਾ ਕੇ ਵੱਡੀ ਉਮਰ ਦੇ ਤੱਕ ਹਰ ਕੋਈ ਉਸਨੂੰ ਸਮਝ ਸਕਦਾ ਪੰਜਾਬੀ ਦੇ ਜਿਹੜੇ ਸ਼ਬਦ ਨੇ ਉਹ ਬਹੁਤ ਹੀ ਘੜੇ ਅਤੇ ਪਰ ਸਮਝੇ ਹੋਏ ਸ਼ਬਦ ਨੇ ਜਿਹੜੇ ਉਹ ਮੀਡੀਆ ਦੁਆਰਾ ਵਰਤੇ ਜਾਂਦੇ ਨੇ ਤਾਂ ਕਿ ਕਿ ਮੀਡੀਆ ਦੁਆਰਾ ਜੋ ਸ਼ਬਦ ਵਰਤੇ ਜਾਂਦੇ ਨੇ ਉਹਨਾਂ ਦੇ ਉੱਪਰ ਕੋਈ ਇਸ ਤਰ੍ਹਾਂ ਨਾ ਹੋਵੇ ਕਿ ਸਾਨੂੰ ਨਾ ਸਮਝ ਆਉਣ ਮੀਡੀਆ ਬਹੁਤ ਹੀ ਵਧੀਆ ਸਿੱਖਿਆ ਜਿਹੜੀ ਉਹ ਮਤਲਬ ਸਾਨੂੰ ਭਾਸ਼ਾ ਜਿਹੜੀ ਮੀਡੀਆ ਦੀ ਉਹ ਬਹੁਤ ਹੀ ਵਧੀਆ ਢੰਗ ਨਾਲ ਲੋਕਾਂ ਅੱਗੇ ਪੇਸ਼ ਕੀਤੀ ਜਾਂਦੀ ਹੈ ਮੀਡੀਆ ਬਹੁਤ ਹੀ ਵਧੀਆ ਅਤੇ ਉੱਚਿਤ ਰੂਪ ਵਿੱਚ ਆਪਣਾ ਕੰਮ ਕਰ ਰਿਹਾ ਅਤੇ ਇਸੇ ਤਰ੍ਹਾਂ ਮੀਡੀਆ ਜਿਹੜਾ ਉਹ ਆਪਣਾ ਕੰਮ ਕਰਦਾ ਰਹੇ ਤਾਂ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਖ਼ਬਰ ਹੈ ਉਹ ਘਰ ਬੈਠੇ ਔਫਿਸ ਬੈਠੇ ਪ੍ਰਾਪਤ ਹੋ ਸਕੇ ਇੰਨੀ ਕੁ ਪੰਜਾਬੀ ਚੰਗੀ ਲਿਖੀ ਜਾਂਦੀ ਹੈ ਮੀਡੀਆ ਦੁਆਰਾ ਰਾਈਟਰਾਂ ਦੁਆਰਾ ਕਿ ਉਹ ਸਾਨੂੰ ਜਿੱਦਾਂ ਅਸੀਂ ਇੱਦਾਂ ਲੱਗਦਾ ਜਿਵੇਂ ਨਿਊਜ਼ ਪੇਪਰ ਜਾਂ ਕੋਈ ਕਿਤਾਬ ਪੜ੍ਹ ਰਹੇ ਹੁੰਦੇ ਹਾਂ ਇਸੇ ਤਰ੍ਹਾਂ ਸਾਨੂੰ ਉਹ ਹਰ ਚੈਨਲ 'ਤੇ ਦਿਖਾਇਆ ਜਾਂਦਾ ਸਮਝਾਇਆ ਜਾਂਦਾ ਮੈਂ ਮੀਡੀਆ ਦਾ ਉਸ ਸਿੱਖਿਆ ਪ੍ਰਣਾਲੀ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ